ਨਮਸਕਾਰ ਜੀ ਨਰੇਸ਼ ਕੁਮਾਰ ਬੋਲ ਰਿਹਾ ਜਿੱਦਾਂ ਕਿ ਤੁਸੀਂ ਕਿਹਾ ਕਿ ਯੋਗਾ ਯੋਗਾ ਮਤਲਬ ਕਿ ਇੱਕ ਫ਼ਾਇਦੇਮੰਦ ਚੀਜ਼ ਸਰੀਰ ਵਾਸਤੇ ਬਹੁਤ ਫ਼ਾਇਦੇਮੰਦ ਆ ਇਹ ਜਿੰਨਾ ਮਤਲਬ ਕਿ ਅਸੀਂ ਯੋਗਾ ਕਰਾਂਗੇ ਉੰਨੀ ਸਾਡੀ ਉਮਰ ਜਿਹੜੀ ਆ ਲੰਬੀ ਹੋਵੇਗੀ ਤੰਦਰੁਸਤ ਰਹਾਂਗੇ ਸਰੀਰ ਫਿੱਟ ਰਹੇਗਾ ਸਰੀਰ 'ਚ ਕੋਈ ਦਰਦਾਂ ਕੋਈ ਕੁਛ ਨਹੀਂ ਪੇਟ ਵੀ ਫਿੱਟ ਰਹੇਗਾ ਲੀਵਰ ਦੀ ਕੋਈ ਬਿਮਾਰੀ ਨਹੀਂ ਆਵੇਗੀ ਹਾਰਟ ਦੀ ਕੋਈ ਪ੍ਰੋਬਲਮ ਨਹੀਂ ਆਵੇਗੀ ਜਿੰਨੇ ਵੀ ਮਤਲਬ ਕਿ ਜਿੱਦਾਂ ਪਿਛੋਕੜ ਸਾਡਾ ਗਿਆ ਹੈ ਜਿੱਦਾਂ ਮਤਲਬ ਕਿ ਸਾਡੇ ਬਜ਼ੁਰਗ ਨੇ ਉਹਨਾਂ ਨੇ ਮਤਲਬ ਕਿ ਜਿੰਨੀ ਮਿਹਨਤ ਕੀਤੀ ਹੈ ਜਾਂ ਕਿੱਦਾਂ ਵੀ ਉਹਨਾਂ ਨੂੰ ਬਹੁਤ ਫਾਏ ਫ਼ਾਇਦੇਮੰਦ ਰਿਹਾ ਉਹਨਾਂ ਨੇ ਐਕਸਰਸਾਈਜ਼ ਕੀਤੀਆਂ ਕਿਉਂਕਿ ਪੈਲੀ ਬੰਨਾ ਵੀ ਉਹਨਾਂ ਨੇ ਸਾਂਭਿਆ ਜਾਂ ਕਿੱਦਾਂ ਵੀ ਕੀਤਾ ਜਾ ਮਿਹਨਤ ਕੀਤੀਆਂ ਉਹਨਾਂ ਨੂੰ ਉਹਨਾਂ ਦਾ ਸਰੀਰ ਪੂਰਾ ਫਿਟ ਸੀ ਕਿਸੇ ਦਾ ਪੇਟ ਬਾਹਰ ਨਹੀਂ ਆਉਂਦਾ ਕੋਈ ਲੀਵਰ ਦੀ ਬਿਮਾਰੀ ਨਹੀਂ ਸੀ ਉਮਰਾਂ ਵੀ ਲੰਬੀਆਂ ਹੋਈਆਂ ਸਭ ਕੁਛ ਉਹਨਾਂ ਦੀ ਸਿਹਤ ਵਧੀਆ ਰਹੀ ਸਿਹਤਮੰਦ ਸੀਗੇ ਅੱਜ ਕੱਲ੍ਹ ਦੇ ਲੋਕ ਯੋਗਾ ਵਗੈਰਾ ਨਹੀਂ ਕਰਦੇ ਹੈਗੇ ਉਹਨਾਂ ਦੇ ਦੇਖੋ ਤੁਸੀਂ ਪੇਟ ਵੀ ਵਧੇ ਹੋਏ ਹੈ ਲੀਵਰ ਦੀ ਬਿਮਾਰੀ ਕਿਸੇ ਨੂੰ ਹਾਰਟ ਦੀ ਬਿਮਾਰੀ ਹੈਗੀ ਡਾਕਟਰਾਂ ਕੋਲ ਰਸ਼ ਪਿਆ ਹੋਇਆ ਪੂਰਾ ਸਿਰਫ਼ ਇਸ ਕਰਕੇ ਕਿ ਅਸੀਂ ਯੋਗਾ ਵਗੈਰਾ ਕੁਛ ਨਹੀਂ ਕਰਦੇ ਅਸੀਂ ਸਵੇਰੇ ਉੱਠ ਕੇ ਸਿੱਧਾ ਹੀ ਕੰਮ 'ਤੇ ਜਾਣ ਨੂੰ ਕਰਦੇ ਹਾਂ ਕੰਮ 'ਤੇ ਵੀ ਜਾ ਕੇ ਬੈਠੇ ਰਹਿੰਦੇ ਹਾਂ ਰਾਤ ਨੂੰ ਆਉਂਦੇ ਹਾਂ ਦੁਪਹਿਰ ਨੂੰ ਵੀ ਖਾਣਾ ਖਾਣਾ ਰਾਤ ਵੀ ਆ ਕੇ ਖਾਣਾ ਖਾ ਕੇ ਅਸੀਂ ਸੋ ਜਾਂਦੇ ਹਾਂ ਸੈਰ ਕਰੋ ਰਾਤ ਵੀ ਸੈਰ ਕਰੋ ਯੋਗਾ ਕਰੋ ਪਿਛੋਕੜ ਬਾਰੇ ਇਹ ਦੇਖੋ ਵੀ ਪੁਰਾਣੇ ਲੋਕਾਂ 'ਚ ਸਾਡੀ ਕਿੱਡੀਆਂ ਵੱਡੀਆਂ ਲੰਬੀਆਂ ਉਮਰਾਂ ਕੱਟੀਆਂ ਨੇ ਅੱਜ ਕੱਲ੍ਹ ਤਾਂ ਪੰਜਾਹ ਸੱਠ ਸਾਲ ਦੀ ਉਮਰ ਕੱਢਣੀ ਵੀ ਬੜੀ ਔਖੀ ਹੋ ਰਹੀ ਹੈ ਇਸ ਲਈ ਯੋਗਾ ਕਰਨਾ ਬਹੁਤ ਜ਼ਰੂਰੀ ਹੈ ਧੰਨਵਾਦ ਜੀ